ਹਰ ਕੋਈ ਆਪਣੇ ਘਰ ਦੇ ਵਿੱਚ ਹਰ ਤਰ੍ਹਾਂ ਦੇ ਫੁੱਲ ਫਲ ਅਤੇ ਸ ਸਬਜ਼ੀਆਂ ਉਗਾਉਣ ਬਾਰੇ ਸੋਚਦਾ ਹੈ ਪਰ ਜੇ ਮੈਂ ਗੱਲ ਕਰਾਂ ਤਾਂ ਮੈਂ ਆਪਣੇ ਘਰ ਵਿੱਚ ਫਲ ਅਤੇ ਸਬਜ਼ੀਆਂ ਉਗਾਉਣ ਬਾਰੇ ਸੋਚਾਂਗਾ ਕਿਉਂਕਿ ਫਲ ਕਿਉਂਕਿ ਇਹ ਘਰ ਦੀਆਂ ਤਾਜ਼ੀਆਂ ਅਤੇ ਸਾਫ ਸੁਥਰੇ ਫਲ ਅਤੇ ਸਬਜ਼ੀਆਂ ਹੋਣਗੀਆਂ ਜੋ ਕਿ ਮੇਰੀ ਸਿਹਤ ਨੂੰ ਬਿਲਕੁਲ ਵੀ ਹਾਨੀ ਨਹੀਂ ਹੋਣਗੀਆਂ ਬਲਕਿ ਜੇ ਅਸੀਂ ਬਾਹਰ ਦੀਆਂ ਸਬਜ਼ੀਆਂ ਅਤੇ ਫਲ ਖਾਂਦੇ ਹਨ ਉਹਨਾਂ ਵਿੱਚ ਟੀਕੇ ਅਤੇ ਕਈ ਹੋਰ ਤਰ੍ਹਾਂ ਦੇ ਦਵਾਈਆਂ ਦਾ ਮਿਸ਼ਰਨ ਕੀਤਾ ਜਾਂਦਾ ਹੈ ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਇਸ ਦੇ ਨਾਲ ਨਾਲ ਘਰ ਦੇ ਵਿੱਚ ਫਲ ਅਤੇ ਸਬਜ਼ੀਆਂ ਉਗਾਉਣ ਨਾਲ ਪੈਸੇ ਦੀ ਬ ਬੱਚਤ ਵੀ ਹੁੰਦੀ ਹੈ ਅਤੇ ਸਾਨੂੰ ਇਸ ਦੇ ਨਾਲ ਘਰ ਦਾ ਵਾਤਾਵਰਨ ਵੀ ਸਾਫ ਰਹਿੰਦਾ ਹੈ ਅਤੇ ਵੱਖ ਵੱਖ ਤਰ੍ਹਾਂ ਦੀ ਚਿੜੀਆਂ ਅਤੇ ਜਾਨਵਰ ਆ ਕੇ ਉਸ 'ਤੇ ਚਿਰਕਟ ਚਿਰਕਟ ਕਰਦੇ ਰਹਿੰਦੇ ਹਨ ਜੋ ਕਿ ਘਰ ਦੇ ਵਾਤਾਵਰਨ ਨੂੰ ਬਹੁਤ ਹੀ ਸ਼ੁੱਧ ਬਣਾਉਂਦਾ ਹੈ ਜੇਕਰ ਜੇ ਗੱਲ ਕਰੀਏ ਤਾਂ ਘਰ ਦੀ ਸ ਸਬਜ਼ੀ ਅਤੇ ਫਲਾਂ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਇਹਨਾਂ ਦਾ ਰੰਗ ਇਹਨਾਂ ਦਾ ਸਾਈਜ਼ ਵੀ ਬਹੁਤ ਹੀ ਵਧੀਆ ਅਤੇ ਬਹੁਤ ਹੀ ਸਵਾਦਿਸ਼ ਹੁੰਦਾ ਹੈ ਜੇ ਮੈਂ ਗੱਲ ਕਰਾਂ ਤਾਂ ਜੇ ਮੈਂ ਗੱਲ ਕਰਾਂ ਤਾਂ ਮੈਂ ਸਭ ਤੋਂ ਵੱਧ ਆਪਣੇ ਘਰ ਵਿੱਚ ਆਲੂ ਅਤੇ ਟਮਾਟਰ ਉਗਾਉਣ ਬਾਰੇ ਸੋਚਾਂਗਾ ਜੋ ਕਿ ਬਹੁਤ ਹੀ ਵਧੀਆ ਅਤੇ ਹੈਲਦੀ ਸਬਜ਼ੀਆਂ ਹਨ